ਕਹਿੰਦੇ ਪੰਜਾਬੀ ਜੰਮਦੇ ਵੀ ਮਨੋਰੰਜਨ ਨਾਲ ਹੈ ਅਤੇ ਮਰਦੇ ਵੀ ਜੰਮਦੇ ਹੈ ਤਾਂ ਕਿਲਕਾਰੀਆਂ ਪਾ ਕੇ ਰੋ ਕੇ ਘਰ ਦੇ ਖੁਸ਼ੀਆਂ ਖੁਸ਼ੀਆਂ ਮਨਾਉਂਦੇ ਹੈ ਮਰਦੇ ਹੈ ਤਾਂ ਕੀਰਨੇ ਪੈਂਦੇ ਹੈ ਕਿ ਇਸ ਜਹਾਨ ਤੋਂ ਛੇਤੀ ਚਲਾ ਗਿਆ ਤਾਂ ਇਸ ਮਨੋਰੰਜਨ ਨੂੰ ਜਿਉਂਦਾ ਹੈ ਰੱਖਿਆ ਸਾਡੇ ਗਾਇਕਾਂ ਨੇ ਸਾਡੇ ਲੋਕ ਗਾਇਕਾਂ ਨੇ ਸਾਡੇ ਸੂਫੀ ਲੋਕ ਗਾਇਕ ਉਹਨਾਂ ਵਿੱਚ ਮੈਨੂੰ ਗਾਇਕ ਬਹੁਤ ਸ ਪਸੰਦ ਨੇ ਰਣਜੀਤ ਬਾਵਾ ਸਤਿੰਦਰ ਸਰਤਾਜ ਜੀ ਵਾਰਿਸ ਭਰਾ ਮਨਮੋਹਨ ਵਾਰਿਸ ਭਰਾ ਸਤਿੰਦਰ ਸਰਤਾਜ ਦੇ ਤਾਂ ਮੈਨੂੰ ਬਹੁਤ ਗਾਣੇ ਪਸੰਦ ਨੇ ਉਹਨਾਂ ਦਾ ਗਾਣਾ ਆਇਆ ਸੀ ਸਾਈਂ ਸਾਈਂ ਵੇ ਸਾਡੀ ਫਰਿਆਦ ਤੇਰੇ ਲਈ ਸਤਿੰਦਰ ਜੀ ਦਾ ਜੋ ਲਹਿਜਾ ਹੈ ਨਾ ਉਹਨਾਂ ਦਾ ਲਿਖਣ ਦਾ ਲਹਿਜਾ ਤਾਂ ਨਹੀਂ ਮੈਂ ਦੇਖਿਆ ਉਹ ਕਿਵੇਂ ਲਿਖਦੇ ਨੇ ਉਹਨਾਂ ਦੇ ਗਾਉਣ ਦਾ ਲਹਿਜਾ ਉਹਨਾਂ ਦਾ ਜੋ ਸਰੀਰ ਦਾ ਜੋ ਮਤਲਬ ਪੋਸਚਰ ਹੈ ਗਾਉਣ ਦਾ ਬੈਠਣ ਦਾ ਤਰੀਕਾ ਬਾ ਕਮਾਲ ਹੈ ਗਾਇਕੀ ਵੀ ਬਾਈ ਬਾ ਕਮਾਲ ਹੈ ਸਰਤਾਜ ਦੀ ਇਹਦੇ ਬਾਰੇ ਮੈਨੂੰ ਯਾਦ ਹੈ ਮੈਂ ਅਖ਼ਬਾਰ ਦੇ ਵਿੱਚ ਪੜ੍ਹਿਆ ਸੀ ਵੀ ਸਰਤਾਜ ਜੀ ਪੀ ਐਚ ਡੀ ਕੀਤੀ ਹੈ ਉਹਨਾਂ ਨੇ ਮਿਊਜਿਕ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਜਿੱਥੋਂ ਕਿ ਦੇਸ਼ ਦੇ ਮਹਾਨ ਉੱਘੇ ਆਰਥਿਕ ਸਮਾਜਿਕ ਰਾਜਨੀਤਿਕ ਲੋਕ ਨਿਕਲੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜੋ ਕਿ ਪੰਜਾਬ ਦਾ ਦਿਲ ਵੀ ਹੈ ਆਪਾਂ ਗੱਲ ਕਰ ਰਹੇ ਸੀ ਰਾ ਗਾਇਕੀ ਦੀ ਸਰਤਾਜ ਜੀ ਦਾ ਦੋ ਤਿੰਨ ਗਾਣੇ ਮੈਨੂੰ ਬਹੁਤ ਪਸੰਦ ਨੇ ਇੱਕ ਤਾਂ ਸਾਈਂ ਕਿ ਉਹਨਾਂ ਨੇ ਪਰਮਾਤਮਾ ਸਾਈ ਨੂੰ ਨਿਵੇਦਨ ਕੀਤਾ ਵੀ ਸਾਡੀ ਫਰਿਆਦ ਸਿਰਫ ਤੇਰੇ ਤੱਕ ਹੀ ਹੈ ਦੁਨੀਆਦਾਰੀ ਦੇ ਵਿੱਚ ਸਨਮਾਨਿਤ ਰਿਸ਼ਤੇ ਅੱਜ ਕੱਲ੍ਹ ਪੈਸੇ ਦੌਰ ਝੂਠੇ ਪੈਂਦੇ ਜਾ ਰਹੇ ਆ ਇੱਕ ਉਹਨਾਂ ਨੇ ਕੀਤਾ ਸੀਗਾ ਜੇ ਨਾ ਜੇ ਨਾਂ ਰਹੀ ਹਰਿਆਲੀ ਫਿਰ ਕੀ ਕਰਨਾ ਤਖਤਾਂ ਨੂੰ ਸੁਣ ਭਾਈ ਆਰੇ ਵਾਲਿਆ ਫਿਰ ਨਾ ਚੀਰ ਦਰਖਤਾਂ ਨੂੰ ਵਾਤਾਵਰਨ ਨੂੰ ਬਚਾਉਣ ਦੇ ਲਈ ਸਰਤਾਜ ਜੀ ਦਾ ਬਹੁਤ ਵੱਡਾ ਸੁਨੇਹਾ ਔਰ ਬੜੇ ਗਾਣੇ ਦੀ ਖੂਬਸੂਰਤ ਲਾਈਨਾਂ ਰਾਹੀਂ ਉਹਨਾਂ ਨੇ ਇੱਕ ਬੰਦੇ ਨੂੰ ਅਗਾਹ ਕੀਤਾ ਵੀ ਭਾਈ ਜੇ ਹਰਿਆਲੀ ਨਾ ਰਹੀ ਤਾਂ ਤਖਤਾਂ ਨੂੰ ਕੀ ਕਰੇਗਾ ਇਸ ਕਰਕੇ ਸਰਤਾਜ ਜੀ ਨੇ ਵਾਤਾਵਰਨ ਬਾਰੇ ਗੱਲ ਕੀਤੀ ਹੈ ਸਰਤਾਜ ਜੀ ਨੇ ਅੱਜ ਦੇ ਜੋ ਪਰਮਾਣੂ ਦਾ ਦੌਰ ਹੈ ਨਿਯੂਕਲੀਅਰ ਦਾ ਦੌਰ ਹੈ ਉਹਦੇ ਵਿੱਚ ਬਹੁਤ ਸੋਹਣਾ ਇੱਕ ਉਹਨਾਂ ਦਾ ਗਾਣਾ ਆਇਆ ਸੀ ਉਹਨਾਂ ਦਾ ਗਾਣਾ ਸੀਗਾ ਬੰਦੇ ਦੇ ਹੱਥਾਂ ਵਰਗਾ ਕੋਈ ਹਥਿਆਰ ਨਹੀਂ ਬਣਿਆ ਬੜਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਕੁਦਰਤ ਤੋਂ ਪਾਰ ਕੁਝ ਨਹੀਂ ਬਣਿਆ ਬੰਦੇ ਨੇ ਆਰਟੀਫਿਸ਼ਲ ਇੰਟੈਲੀਜੈਂਟ ਨਿਊਕਲੀਅਰ ਪਾਵਰਸ ਆ ਗਈਆਂ ਨੇ ਦੁਨੀਆਂ ਬਰੂਦ ਦੇ ਢੇਰ ਤੇ ਬੈਠੀ ਆ ਪਰ ਕੁਦਰਤ ਤੋਂ ਬਾਹਰ ਕੁਝ ਨਹੀਂ ਬਣਿਆ ਕੁਦਰਤ ਦੇ ਨਾਲ ਹੀ ਸਭ ਕੁਝ ਹੈ ਤਾਂ ਉਹ ਗਾਇਕ ਮੈਨੂੰ ਦਿਲੋਂ ਪਸੰਦ ਹੈ ਕਿਉਂਕਿ ਉਹਦੀ ਲੇਖਣੀ ਦੇ ਵਿੱਚ ਸੂਫੀਆਨਾ ਕਲਾਮ ਹੈ ਸੂਫੀ ਲਿਖਦਾ ਉਰਦੂ ਸ਼ਾਇਰੀ ਫਾਰਸੀ ਔਰ ਪੰਜਾਬੀ ਦਾ ਸੁਮੇਲ ਹੈ ਉਹਦੀ ਗਾਇਕੀ ਦੇ ਵਿੱਚ ਮੈਨੂੰ ਬਹੁਤ ਪਸੰਦ ਆ ਜਦੋਂ ਵੀ ਕਿਤੇ ਮੈਂ ਇਕੱਲਾ ਬੈਠਾ ਹੋਣ ਮੈਂ ਸਰਤਾਜ ਜੀ ਨੂੰ ਸੁਣਦਾ ਹਾਂ ਮਹਿਸੂਸ ਕਰਦੇ ਹਾਂ ਉਹਨਾਂ ਨੇ ਸ਼ਬਦਾਂ ਨੂੰ ਇਕੱਲੇ ਇਕੱਲੇ ਨੂੰ ਬਹੁਤ ਸੋਹਣਾ